ਪੀਟੀ ਊਸ਼ਾ ਇੱਕ ਦੌੜਾਕ ਸੀ ਪੀਟੀ ਊਸ਼ਾ ਪਿਓਲੀ ਤੋਂ ਸੀ ਐਥਲੀਟ ਦੀ ਸ਼ੁਰੂਆਤ ਉਹਨਾਂ ਨੇ ਮਤਲਬ ਉੱਥੋਂ ਕੀਤੀ ਅਤੇ ਪੀਟੀ ਊਸ਼ਾ ਨੂੰ ਪਿਓਲੀ ਦੀ ਐਕਸਪ੍ਰੈਸ ਵੀ ਕਹਿੰਦੇ ਸੀ ਠੀਕ ਹੈ ਪੀਟੀ ਊਸ਼ਾ ਨੇ ਚੈਂਪੀਅਨ ਨਾਲ ਮੁਕਾਬਲਾ ਵੀ ਕੀਤਾ ਅਤੇ ਉਹ ਮਤਲਬ ਚੌਥੀ ਕਲਾਸ ਤੋਂ ਹੀ ਮੁਕਾਬਲੇ ਦੀ ਸ਼ੁਰੂਆਤ ਕਰਦੀ ਸੀ ਮਤਲਬ ਚੌਥੀ ਕਲਾਸ ਤੋਂ ਹੀ ਸਿੱਖਣਾ ਮਤਲਬ ਦੌੜਨਾ ਸ਼ੁਰੂ ਕੀਤਾ ਸੀ ਇੱਕ ਉਹਨਾਂ ਦਾ ਕੋਚ ਬਹੁਤ ਵਧੀਆ ਸੀ ਜਿਹਨਾਂ ਨੇ ਉਹਨੂੰ ਮਤਲਬ ਸਿਖਾਇਆ ਬਹੁਤ ਵਧੀਆ ਜਾਂ ਵੀ ਬਚਪਨ ਤੋਂ ਹੀ ਉਹਨਾਂ ਨੂੰ ਵੀ ਤਿਆਰੀ ਕਰਵਾਈ ਪੀਟੀ ਊਸ਼ਾ ਉੱਨੀ ਸੌ ਅੱਸੀ ਵੇਲੇ ਦੀ ਸੀ ਉਹਨਾਂ ਨੂੰ ਇੱਕ ਉੜਨ ਪਰੀ ਵੀ ਕਹਿੰਦੇ ਸੀ ਅਤੇ ਉਹਨਾਂ ਨੂੰ ਮਤਲਬ ਭਾਰਤ ਸਰਕਾਰ ਨੇ ਉਹਨਾਂ ਨੂੰ ਅਰਜੁਨ ਅਤੇ ਪਦਮ ਸ਼੍ਰੀ ਅਵਾਰਡ ਨਾਲ ਵੀ ਨਿਵਾਜਿਆ ਸੀ ਉਹ ਉਹਨਾਂ ਨੇ ਮਤਲਬ ਗੋਲਡ ਮੈਡਲ ਵੀ ਜਿੱਤੇ ਸੀਗੇ ਅਤੇ ਉਹ ਇੱਕ ਮਤਲਬ ਨਾਰੀ ਸ਼ਕਤੀ ਦਾ ਪ੍ਰਤੀਕ ਹੈ ਪੀਟੀ ਊਸ਼ਾ ਅਤੇ ਜਿਵੇਂ ਆਪਾਂ ਕਹਿ ਦਈਏ ਵੀ ਉਹਨਾਂ ਤੋਂ ਸਿੱਖਣ ਨੂੰ ਜਿਵੇਂ ਉਹ ਜਿਵੇਂ ਅਸ ਉੱਨੀ ਸੌ ਅੱਸੀ ਦੇ ਵਿੱਚ ਵੀ ਬੂੜੀਆਂ ਦਾ ਕੋਈ ਬਾਹਰ ਖੇਡਣਾ ਇੱਦਾਂ ਦੇ ਮਤਲਬ ਖੇਡ ਦੇ ਵਿੱਚ ਜਾਣਾ ਤਾਂ ਬਹੁਤ ਨਹੀਂ ਮੰਨਿਆ ਜਾਂਦਾ ਸੀ ਵਧੀਆ ਅਤੇ ਉਹਨਾਂ ਨੇ ਮਤਲਬ ਉਦੋਂ ਉਹ ਪਹਿਲੀ ਦੌੜਾਕ ਸੀਗੀ ਉਦੋਂ ਦੀ ਉੱਨੀ ਸੌ ਅੱਸੀ ਵੇਲੇ ਦੀ ਜਿਵੇਂ ਅਤੇ ਉਹਨਾਂ ਤੋਂ ਤਾਂ ਇਹੀ ਸਿੱਖਣ ਨੂੰ ਮਿਲਦਾ ਵੀ ਆਪਣਾ ਕੀ ਨਾਮ ਹੈਗਾ ਵੀ ਜੇ ਆਪਦੇ ਅੰਦਰ ਕੋਈ ਟੈਲੈਂਟ ਹੈਗਾ ਅਤੇ ਉਸ ਨੂੰ ਵੀ ਤੁਸੀਂ ਕੀ ਨਾਮ ਹੈਗੇ ਆ ਵੀ ਇੱਦਾਂ ਨਾ ਸੋਚੋ ਦੁਨੀਆਂ ਦੀ ਨਾ ਪਰਵਾਹ ਕਰੋ ਵੀ ਤੁਸੀਂ ਆਪਣਾ ਕੀ ਨਾਮ ਹੈਗਾ ਕੰਮ ਕਰਦੇ ਜਾਓ ਜੇ ਕੋਈ ਇੱਛਾ ਹੈਗੀ ਤਾਂ ਆਪਣੀ ਮਤਲਬ ਜੇ ਕੋਈ ਤੁਹਾਡੇ 'ਚ ਹੁਨਰ ਹੈਗਾ ਉਹ ਜਾਂ ਕੋਈ ਕਲਾ ਏ ਜਿਵੇਂ ਵੀ ਮਤਲਬ ਆਪਦਾ ਤੁਸੀਂ ਇਹ ਵੀ ਪ੍ਰਦਰਸ਼ਨ ਕਰ ਸਕਦੇ ਹੋ ਜਾਂ ਦਿਖਾ ਸਕਦੇ ਹੋ